ਦੇਖਿਆ ਜਾਵੇ ਤਾਂ ਸਾਡੀ ਰਸੋਈ ਵਿੱਚ ਬਹੁਤ ਤਰੀਕੇ ਦੇ ਬਰਤਨ ਹੁੰਦੇ ਹਨ ਜਿਵੇਂ ਕਿ ਚਾਹ ਵਾਲਾ ਉਸਦੇ ਵਿੱਚ ਅਸੀਂ ਚਾਹ ਬਣਾਉਂਦੇ ਹਾਂ ਕਈਆਂ ਦੇ ਘਰਾਂ ਵਿੱਚ ਛੋਟੇ ਚਾਹ ਵਾਲੇ ਹੁੰਦੇ ਹਨ ਕਈਆਂ ਦੇ ਵਿੱਚ ਬੜੇ ਹੁੰਦੇ ਹਨ ਜਿਸ ਵਿੱਚ ਦੁੱਧ ਵੀ ਗਰਮ ਕਰ ਸਕਦੇ ਹਨ ਅਤੇ ਰਹੀ ਗੱਲ ਇੱਕ ਉਸਦੇ ਵਿੱਚ ਕੁੱਕਰ ਆਉਂਦਾ ਹੈ ਪਹਿਲਾਂ ਕਿਯਾ ਹੁੰਦਾ ਸੀ ਲੋਕ ਪਤੀਲੇ ਵਿੱਚ ਦਾਲਾਂ ਦੂਲਾਂ ਬਣਾਉਂਦੇ ਸੀ ਉਹਦੇ ਵਿੱਚ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਪਰ ਅੱਜ ਕੱਲ੍ਹ ਕੁੱਕਰ ਆ ਗਿਆ ਹੈ ਜਿਹਦੇ ਵਿੱਚ ਆਪਾਂ ਸਬਜ਼ੀ ਸੁਬਜ਼ੀ ਛੋਲੇ ਵਗੈਰਾ ਕੁਛ ਵੀ ਬਣਾਈਏ ਤਾਂ ਇੱਕ ਦੋ ਸੀਟੀਆਂ ਦੇ ਵਿੱਚ ਹੀ ਸਾਡਾ ਕੰਮ ਬਣ ਜਾਂਦਾ ਹੈ ਅਤੇ ਦੂਜੀ ਗੱਲ ਇਸ ਤੋਂ ਬਾਅਦ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਨੋਨ ਸਟਿਕ ਸਮਾਨ ਜ਼ਿਆਦਾ ਆ ਗਿਆ ਹੈ ਨੋਨ ਸਟਿਕ ਭਾਂਡੇ ਆ ਗਏ ਹਨ ਜਿਹਨਾਂ ਦੇ ਉੱਪਰ ਖਾਣਾ ਵਗੈਰਾ ਚਿੱਪਕਦਾ ਨਹੀਂ ਹੈ ਅਤੇ ਇਸ ਤਰ੍ਹਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਦੂਜੀ ਗੱਲ ਉਹਨਾਂ ਨੂੰ ਧੌਣਾ ਧੁਣਾ ਵੀ ਬਹੁਤ ਅਸਾਨ ਹੁੰਦਾ ਹੈ ਅਤੇ ਰਹੀ ਗੱਲ ਇੱਕ ਫ਼ਰਾਈਪੈਨ ਆਉਂਦਾ ਹੈ ਜਿਹਦੇ ਵਿੱਚ ਆਪਾਂ ਤੜਕਾ ਤੁੜਕਾ ਅਲੱਗ ਐਕਸਟਰਾਂ ਲਗਾ ਸਕਦੇ ਹਾਂ